ਆਮ ਤੌਰ 'ਤੇ ਅਸੀਂ ਦੁਪਹਿਰ ਦੇ ਅਤੇ ਰਾਤ ਦੇ ਖਾਣੇ ਵਿੱਚ ਕਈ ਤਰ੍ਹਾਂ ਦੇ ਪਕਵਾਨ ਪਕਾਉਂਦੇ ਹਾਂ ਅਸੀਂ ਤੁਹਾਨੂੰ ਦੱਸੀਏ ਕਿ ਜਿਵੇਂ ਅਸੀਂ ਦੁਪਹਿਰੇ ਚੌਲ ਮੈਗੀ ਪੋਹਾ ਆਦਿ ਕਈ ਤਰ੍ਹਾਂ ਦੇ ਪਕਵਾਨ ਬਣਾ ਸਕਦੇ ਹਾਂ ਜੇਕਰ ਅਸੀਂ ਸਵੇਰੇ ਕੋਈ ਹੈਵੀ ਭੋਜਨ ਖਾਧਾ ਹੈ ਤਾਂ ਦੁਪਹਿਰੇ ਕੁਛ ਹਲਕਾ ਭੋਜਨ ਬਣਾ ਲਈਦਾ ਹੈ ਰਾਤ ਦੇ ਖਾਣੇ ਵਿੱਚ ਅਸੀਂ ਸਬਜ਼ੀ ਅਤੇ ਰੋਟੀ ਬਣਾਉਂਦੇ ਹਾਂ ਦੁਪਹਿਰੇ ਜ਼ਿਆਦਾਤਰ ਲੋਕ ਚੌਲ ਖਾਣਾ ਪਸੰਦ ਕਰਦੇ ਹਾਂ ਅਸੀਂ ਵੀ ਰਾਤ ਦੇ ਖਾਣੇ ਵਿੱਚ ਸਬਜ਼ੀ ਅਤੇ ਰੋਟੀ ਹੀ ਖਾਣੀ ਪਸੰਦ ਕਰਦੇ ਹਾਂ ਦੁਪਹਿਰੇ ਅਸੀਂ ਚੌਲ ਬਣਾ ਲੈਂਦੇ ਹਾਂ ਸਾਡੇ ਘਰ ਵਿੱਚ ਜ਼ਿਆਦਾ ਨਮਕ ਵਾਲੇ ਚੌਲ ਹੀ ਪਸੰਦ ਕੀਤੇ ਜਾਂਦੇ ਹਨ ਰਾਤ ਨੂੰ ਅਸੀਂ ਸਬਜ਼ੀ ਅਤੇ ਰੋਟੀ ਬਣਾਉਂਦੇ ਹਾਂ ਸਬਜ਼ੀ ਸਾਡੇ ਘਰ ਵਿੱਚ ਜ਼ਿਆਦਾ ਚਨਿਆਂ ਦੀ ਪਸੰਦ ਕੀਤੀ ਜਾਂਦੀ ਹੈ ਕਿਉਂਕਿ ਤਰੀ ਵਾਲੀ ਸਬਜ਼ੀ ਹੀ ਬਜ਼ੁਰਗ ਜ਼ਿਆਦਾ ਪਸੰਦ ਕਰਦੇ ਹਨ ਬੱਚਿਆਂ ਨੂੰ ਵੀ ਮੈਗੀ ਪੋਹਾ ਆਦਿ ਪਸੰਦ ਆਉਂਦਾ ਹੈ ਚਨਿਆਂ ਦੀ ਸਬਜ਼ੀ ਖਾਣ ਨਾਲ਼ ਸਾਡਾ ਸਿਹਤ ਬਹੁਤ ਵਧੀਆ ਰਹਿੰਦੀ ਹੈ ਸਾਨੂੰ ਉਹੀ ਭੋਜਨ ਖਾਣਾ ਚਾਹੀਦਾ ਹੈ ਜਿਹੜਾ ਸਾਡੀ ਸਿਹਤ ਲਈ ਬਹੁਤ ਵਧੀਆ ਰਹਿੰਦਾ ਹੈ